ਸਾਡੇ ਪਿੰਡ ਵਿੱਚ ਬਹੁਤ ਇਤਿਹਾਸਿਕ ਗੱਲਾਂ ਹਨ ਜਿਵੇਂ ਸਾਡੇ ਪਿੰਡ ਦੇ ਸੇਠ ਬਹੁਤ ਮਾਇਆਧਾਰੀ ਸਨ ਜਦੋਂ ਕੋਈ ਗਰੀਬ ਆ ਕੇ ਲੜਕੀ ਦੇ ਵਿਆਹ ਦਾ ਵਾਸਤਾ ਪਾਉਂਦਾ ਜਾਂ ਕੋਈ ਹੋਰ ਮਦਦ ਦਾ ਵਾਸਤਾ ਪਾਉਂਦਾ ਤਾਂ ਉਹ ਬਿਨਾਂ ਦੇਖੇ ਸਮਝੇ ਜਿੰਨੇ ਪੈਸੇ ਮੰਗਦੇ ਦੇ ਦਿੰਦੇ ਸੀ ਓ ਓਰ ਜਾਂਦੇ ਹੋਏ ਨੂੰ ਵੀ ਕਹਿ ਦਿੰਦੇ ਸੀ ਵੀ ਭਾਈ ਔਖਾ ਨਾ ਹੋਈ ਜੇ ਮੁੜ ਗਏ ਤਾਂ ਮੋੜ ਦੀ ਨਹੀਂ ਨਾ ਸੀ ਤੇਰੇ ਨੇ ਇਸੇ ਤਰੀਕੇ ਨਾਲ ਇਹਨਾਂ ਸੁ ਗੱਲਾਂ ਸੁਣ ਕੇ ਮਹਾਰਾਜਾ ਪਟਿਆਲਾ ਏ ਉਹਨਾਂ ਨੇ ਪੈਸੇ ਮੰਗੇ ਅੱਗੋਂ ਸੇਠਾ ਨੇ ਕਿਹਾ ਬੋਲ ਕਿੰਨੇ ਚਾਹੀਦੇ ਕਿਹੜੇ ਸੰਨ ਦੇ ਚਾਹੀਦੇ ਨੇ ਅਤੇ ਉਹ ਬਸ ਲੈਣਾ ਦਾ ਕੀ ਸੀ ਉਹਨਾਂ ਨੇ ਇਸ ਤੋਂ ਉਹ ਕਹਿੰਦੇ ਵੀ ਠੀਕ ਹੈ ਇਹ ਪਿੰਡ ਬਸ ਹੁੰਡੀ ਵਾਲਾ ਹੀ ਹੈ ਹੁੰਡੀ ਆਲਾ ਬਣ ਗਿਆ ਪਿੰਡ ਹੁੰਡੀ ਆਲੇ ਤੋਂ ਹੌਲੀ ਹੌਲੀ ਹੰਡਾਇਆ ਕਹਿਣ ਲੱਗਗੇ ਪਿੰਡ ਦਾ ਨਾਂ ਹੰਡਾਇਆ ਹੀ ਪੈ ਗਿਆ ਇਸੇ ਤਰੀਕੇ ਨਾਲ ਮਹਾਰਾਜਾ ਗੁਰੂ ਤੇਗ ਬਹਾਦਰ ਜੀ ਹੰਡਿਆਏ ਆਏ ਉਸ ਵੇਲੇ ਪਿੰਡ ਦੇ ਵਿੱਚ ਪਲੇਗ ਦੀ ਬਿਮਾਰੀ ਪਈ ਹੋਈ ਸੀ ਲੋਕ ਬਹੁਤ ਔਖੇ ਮਰ ਰਹੇ ਸੀ ਉਹ ਸੁਣ ਕੇ ਦੇਖ ਕੇ ਲੋਕਾਂ ਨੇ ਉਹਨਾਂ ਕੋਲ ਬੇਨਤੀ ਕਰੀ ਉਹ ਬ ਗੁਰੂ ਤੇਗ ਬਹਾਦਰ ਜੀ ਇੱਕ ਬਰੋਟੇ ਦਾ ਦਰਖਤ ਸੀ ਉੱਥੇ ਬੈਠੇ ਸੀ ਉਹਦੇ ਕੋਲ ਹੀ ਉੱਥੇ ਇੱਕ ਛੋਟਾ ਜਿਹਾ ਪਾਣੀ ਦਾ ਕੋਈ ਛੱਪੜ ਜਿਹਾ ਸੀ ਜਿੱਥੇ ਕਿ ਰਮਦਾਸੀਏ ਆਮ ਚਮੜਾ ਰੰਗ ਦੇ ਧੋਂਦੇ ਹੋਰ ਕਰਦੇ ਜਾਣੇ ਵਧੀਆ ਨਹੀਂ ਸੀਗਾ ਉਸ ਟਾਈਮ 'ਚ ਉਹਨਾਂ ਨੂੰ ਆ ਕੇ ਬੇਨਤੀ ਕਰੀ ਮਹਾਰਾਜ ਲੋਕਾਂ ਬਹੁਤ ਔਖੇ ਨੇ ਇਹਨਾਂ ਦਾ ਕੋਈ ਹੱਲ ਕਰੋ ਤੁਸੀਂ ਤਾਰੋ ਅਤੇ ਬਿਮਾਰੀ ਪਈ ਹੋਈ ਹੈ ਇਹਦਾ ਕੋਈ ਹੱਲ ਲੱਭੋ ਸਾਨੂੰ ਇਹ ਕੰਮ ਕਰਕੇ ਦਿਓ ਤਾਂ ਮਹਾਰਾਜ ਨੇ ਕਿਹਾ ਵੀ ਠੀਕ ਹੈ ਤੁਸੀਂ ਐਂ ਕਰੋ ਆ ਦੇਖੋ ਮੈਂ ਇਸ਼ਨਾਨ ਕਰਦਾ ਇਸ ਛਪੜੀ 'ਚ ਤੁਸੀਂ ਗੰਦੀ ਜਿਹਨੂੰ ਕਹਿੰਦੇ ਹੋ ਪਰ ਇਸ ਦੇ ਵਿੱਚ ਇੰਨੇ ਗੁਣ ਨੇ ਵੀ ਤੁਸੀਂ ਇਸ 'ਤੇ ਇਸ਼ਨਾਨ ਕਰੋ ਤੁਹਾਡੇ ਦੁੱਖ ਦੂਰ ਹੋ ਜਾਣਗੇ ਮਹਾਰਾਜ ਨੇ ਉੱਥੇ ਇਸ਼ਨਾਨ ਕੀਤਾ ਫਿਰ ਉਦੋਂ ਬਾਅਦ ਲੋਕਾਂ ਨੇ ਕੀਤਾ ਲੋਕ ਠੀਕ ਹੋਣ ਲੱਗ ਗਏ ਅੱਜ ਉਹ ਬਹੁਤ ਵਧੀਆ ਇਤਿਹਾਸਕ ਗੁਰਦੁਆਰਾ ਅਤੇ ਤਲਾਬ ਬਣਿਆ ਹੋਇਆ ਹੈ ਉਥੋਂ ਫਿਰ ਹੌਲੀ ਹੌਲੀ ਪਿੰਡ ਦੇ ਛਿਪਦੇ ਕੰਨੀ ਬੱਗ ਗਏ ਉੱਥੇ ਜਾ ਕੇ ਇੱਕ ਜੰਡ ਸੀ ਜੰਡ ਦੇ ਥੱਲੇ ਬੈਠ ਗਏ ਉੱਥੇ ਇੱਕ ਮਾਈ ਨੇ ਕੱਚਾ ਦੁੱਧ ਪਿਆਇਆ ਕੱਚਾ ਦੁੱਧ ਪੀ ਕੇ ਮਹਾਰਾਜ ਖੁਸ਼ ਹੋ ਗਏ ਕਹਿਣ ਲੱਗੇ ਬੀ ਤੇਰੇ ਭਰਭੂਰ ਹੋਵੇਗੀ ਸਾਰਾ ਗੱਲਾਂ ਬਰ ਬਾਰੇ ਦਿੱਤੇ ਉੱਥੇ ਹੁਣ ਗੁਰਦੁਆਰਾ ਕੱਚਾ ਗੁਰੂ ਸਰ ਬਣਿਆ ਹੋਇਆ ਹੈ ਉੱਥੇ ਵੀ ਲੋਕ ਆਉਂਦੇ ਨੇ ਸੁੱਖਾ ਬਰ ਆਉਂਦੀਆਂ ਹਨ ਉਥੋਂ ਫਿਰ ਉਹ ਧੌਲੇ ਕੰਨੀਂ ਨੂੰ ਬੱਗ ਗਏ ਧੌਲੇ ਜਦੋਂ ਗਏ ਧੌਲੇ ਦੀ ਜੂਹ ਆ ਗਈ ਜਦੋਂ ਉਥੋਂ ਘੋੜਾ ਉਹਨਾਂ ਦਾ ਅੜੀ ਪੈ ਗਿਆ ਬ ਗਿਆ ਨਹੀਂ ਗਾਹਾਂ ਜਿਹੜੀ ਨਾਲ ਸੰਗਤ ਸੀ ਉਹਨਾਂ ਨੇ ਪੁੱਛਿਆ ਮਹਾਰਾਜ ਕੀ ਗੱਲ ਗਾਹਾਂ ਨਹੀਂ ਜਾਂਦੇ ਉਹ ਕਹਿੰਦਾ ਭਾਈ ਗਾਹਾਂ ਕੀ ਜਾਣਾ ਗਾਹਾਂ ਤਾਂ ਪ ਆਪਣਾ ਤੰਬਾਕੂ ਬੀਜਿਆ ਹੋਇਆ ਹੈ ਇਹ ਇਹ ਤੰਬਾਕੂ ਆਪਣੇ ਵਾਸਤੇ ਠੀਕ ਨਹੀਂ ਇਹ ਸਾਡਾ ਘੋੜਾ ਉਥੇ ਨਹੀਂ ਵੜ੍ਹਦਾ ਆਪਾਂ ਨੂੰ ਤਾਂ ਕੀ ਠੀਕ ਹੋਣਾ ਸੀ ਇਸ ਕਰਕੇ ਆਪਾਂ ਇੱਥੋਂ ਇਧਰ ਨੂੰ ਗੁੱਡੀ ਵੱਲ ਨੂੰ ਤੁਰ ਚਲਦੇ ਆ ਉੱਥੇ ਫਿਰ ਗੁਰਦੁਆਰਾ ਹੁਣ ਅੜੀਸਰ ਬਣਿਆ ਹੋਇਆ ਹੈ ਗੁਰਦੁਆਰਾ ਅੜੀਸਰ ਇੰਨਾਂ ਮਸ਼ਹੂਰ ਅਤੇ ਇੰਨਾਂ ਵਧੀਆ ਬਣਿਆ ਅਤੇ ਲੋਕਾਂ ਸੰਗਤਾਂ ਦੀ ਲਾਈਨਾਂ ਲੱਗੀਆਂ ਰਹਿੰਦੀਆਂ ਨੇ ਬਹੁਤ ਇਕੱਠ ਹੁੰਦਾ ਔਰ ਬਹੁਤ ਵਧੀਆ ਹੁੰਦਾ ਹੈ